ਹੈਲੋ ਊਬਰ ਕੈਬ ਡਰਾਈਵਰ ਕੱਲ੍ਹ ਮੈਂ ਸਵੇਰੇ ਤੁਹਾਡੀ ਐਪ ਤੋਂ ਊਬਰ ਐਪ ਤੋਂ ਆਪਣੀ ਮੋਹਾਲੀ ਤੋਂ ਚੰਡੀਗੜ੍ਹ ਬਾਈ ਸੈਕਟਰ ਤੱਕ ਊਬਰ ਕੈਬ ਬੁੱਕ ਕੀਤੀ ਸੀ ਜਿਸ ਵਿੱਚ ਮੈਂ ਮੋਹਾਲੀ ਤੋਂ ਚੰਡੀਗੜ੍ਹ ਪਹੁੰਚੀ ਸੀ ਜਦੋਂ ਮੈਂ ਮੋਹਾਲੀ ਚੰਡੀਗੜ੍ਹ ਪਹੁੰਚੀ ਤਾਂ ਮੈਨੂੰ ਉੱਥੇ ਜਾ ਕੇ ਜਦੋਂ ਤੁਸੀਂ ਡਰੋਪ ਕੀਤਾ ਤਾਂ ਮੈਨੂੰ ਪਤਾ ਲੱਗਿਆ ਕਿ ਮੈਂ ਆਪਣਾ ਬੈਗ ਕਾਰ ਵਿੱਚ ਹੀ ਭੁੱਲ ਗਈ ਹਾਂ ਕਿਰਪਾ ਕਰਕੇ ਤੁਸੀਂ ਇਹ ਇਸ ਸੰਬੰਧੀ ਚੈੱਕ ਕਰਕੇ ਮੈਨੂੰ ਇਹ ਦੱਸ ਸਕਦੇ ਹੋ ਕਿ ਮੇਰਾ ਬੈਗ ਤੁਹਾਡੇ ਕੋਲ ਉਪਲਬਧ ਹੈ ਜਾਂ ਨਹੀਂ